ਹਾਂਜੀ ਕਈ ਵਾਰ ਇੱਦਾਂ ਦੇ ਦਿਨ ਆਉਂਦੇ ਹੈ ਕਿ ਜਿੱਦਾਂ ਕਿ ਮੇਰਾ ਕਈ ਵਾਰ ਚਿੱਤਰਕਾਰੀ ਮਨ ਕਰਨ ਦਾ ਨਹੀਂ ਵੀ ਜੀਅ ਕਰਦਾ ਅਤੇ ਫਿਰ ਉਸ ਸਿਚੂਏਸ਼ਨ 'ਚ ਮੈਂ ਕੀ ਕਰਦੀ ਹਾਂ ਮੇਰੀ ਇੱਕ ਬਹੁਤ ਫਰੈਂਡ ਹੈ ਮਤਲਬ ਮੇਰੀ ਬਚਪਨ ਦੀ ਫਰੈਂਡ ਹੈ ਤਾਂ ਉਹਦਾ ਵੀ ਸੇਮ ਹੀ ਇੰਟ੍ਰਸਟ ਹੈ ਉਹਨੂੰ ਵੀ ਚਿੱਤਰਕਾਰ ਬਣਾਉਣ 'ਚ ਵਿੱਚ ਬਹੁਤ ਇੰਟ੍ਰਸਟ ਹੈ ਅਤੇ ਅਸੀਂ ਦੋਨੋਂ ਮਿਲ ਕੇ ਹੀ ਚਿੱਤਰਕਾਰ ਕਰਦੇ ਹਾਂ ਸੀਗੇ ਪਹਿਲਾਂ ਸਕੂਲ ਟਾਈਮ ਔਰ ਉਸ ਤੋਂ ਬਾਅਦ ਕੋਲਜ ਟਾਈਮ ਅਤੇ ਹੁਣ ਮੈਂ ਕੋਲਜ 'ਚ ਪਾਸ ਆਊਟ ਹਾਂ ਬੱਟ ਹਜੇ ਤੱਕ ਵੀ ਉਹ ਮੇਰਾ ਸ਼ੌਂਕ ਜਿਹੜਾ ਹੈਗਾ ਗਿਆ ਨਹੀਂ ਹੈ ਅਤੇ ਫਿਰ ਹੁਣ ਹੁਣ ਕੀ ਹੁੰਦਾ ਹੈ ਜਿੱਦਾਂ ਕਈ ਵਾਰ ਨਹੀਂ ਵੀ ਮਨ ਕਰਦਾ ਤਾਂ ਮੈਂ ਹਮੇਸ਼ਾ ਆਪਣੀ ਉਸ ਹੀ ਫਰੈਂਡ ਨੂੰ ਕੌਲ ਕਰਦੀ ਹਾਂ ਕਿ ਅੱਜ ਮੇਰਾ ਇੱਦਾਂ ਕਰਕੇ ਮਨ ਨਹੀਂ ਕਰਦਾ ਤਾਂ ਉਹ ਮੈਨੂੰ ਹਮੇਸ਼ਾ ਹੀ ਇਸ ਕੰਮ ਦੇ ਲਈ ਹੱਲਾਸ਼ੇਰੀ ਦਿੰਦੀ ਹੈ ਜਾਂ ਫਿਰ ਮੈਂ ਉਹਨੂੰ ਡਰਾਇੰਗ 'ਚ ਪੁੱਛ ਲੈਂਦੀ ਹਾਂ ਕਿ ਮੈਂ ਇੱਥੇ ਕਰਕੇ ਜਿੱਦਾਂ ਇੱਕ ਡਰਾਇੰਗ ਬਣਾਈ ਸੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਇਹਦੇ ਅੱਗੇ ਹੋਰ ਕੀ ਬਣਾਵਾਂ ਤਾਂ ਉਹ ਮੈਨੂੰ ਆਈਡਿਆਸ ਦੇ ਦਿੰਦੀ ਹੈ ਕੇ ਤੂੰ ਵੀ ਸਿੰਪਲ ਇਹਦਾ ਕਰਕੇ ਅੱਗੇ ਇਹਦੇ ਇੱਦਾਂ ਬਣਾ ਦੇ ਤਾਂ ਮੈਨੂੰ ਉਸ ਤੋਂ ਆਈਡਿਆ ਮਿਲ ਜਾਂਦਾ ਅਤੇ ਉਹ ਮੈਨੂੰ ਹਮੇਸ਼ਾ ਹੀ ਇਸ ਕੰਮ ਦੇ ਲਈ ਹੱਲਾਸ਼ੇਰੀ ਦਿੰਦੀ ਹੈ ਅਤੇ ਮੇਰਾ ਕੀ ਹੈ ਮੇਰਾ ਇੱਕ ਸਟ੍ਰਿਕਟ ਰੂਲ ਹੈ ਕਿ ਮੈਂ ਹੁਣ ਈਵਨਿੰਗ ਸ਼ਾਮ ਨੂੰ ਪੰਜ ਵਜੇ ਤੋਂ ਲੈ ਕੇ ਸੱਤ ਵਜੇ ਤੱਕ ਡੇਲੀ ਜੋ ਹੈ ਆਪਣੀ ਚਿੱਤਰਕਾਰੀ ਕਰਦੀ ਹਾਂ ਕਿਉਂਕਿ ਜਦੋਂ ਤੱਕ ਮੈਂ ਇਹ ਨਹੀਂ ਕਰਦੀ ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਮੇਰਾ ਜਿਹੜਾ ਅੱਜ ਦਾ ਜਿਉਣਾ ਹੈ ਉਹ ਸਕਸੈਸਫੁਲ ਨਹੀਂ ਹੋਇਆ ਹੈ ਤਾਂ ਮੈਂ ਡੇਲੀ ਸ਼ਾਮ ਨੂੰ ਜਿਹੜੇ ਦੋ ਘੰਟੇ ਆਪਣੇ ਹੈਗੇ ਹੈ ਉਹ ਇਸ ਕੰਮ ਨੂੰ ਦਿੰਦੀ ਹਾਂ ਅਤੇ ਤਾਂ ਹੀ ਮੈਨੂੰ ਮਤਲਬ ਉਹ ਹੁੰਦਾ ਨਾ ਕਿ ਇੱਕ ਚਿੱਤਰਕਾਰ ਨੂੰ ਉਹ ਕੰਮ ਕਰਕੇ ਉਹ ਸਕੂਨ ਮਿਲਦਾ ਥੈਂਕ ਯੂ